ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣਾ ਗਿਆਨ ਵਧਾਉਣ ਵਾਸਤੇ ਅਖਬਾਰਾਂ ਟੈਲੀਵਿਜ਼ਨ ਅਤੇ ਰੇਡੀਓ ਰਾਹੀਂ ਔਰ ਮੋਬਾਇਲ 'ਤੇ ਸੋਸ਼ਲ ਨੈਟਵਰਕ ਰਾਹੀਂ ਕਾਫੀ ਗਿਆਨ ਮਿਲਦਾ ਹੈ ਲੇਕਿਨ ਉਸ ਦੇ ਨਾਲ ਨਾਲ ਉਹ ਫਿਰ ਵੀ ਅਖਬਾਰਾਂ ਦੇ ਥਰੂ ਸਭ ਕੁਝ ਪੜ੍ਹ ਕੇ ਦੇਖ ਕੇ ਦੁਨੀਆਂ ਦੇ ਬਾਰੇ ਹਰ ਨਵੀਂ ਔਰ ਪੁਰਾਣੀ ਚੀਜ਼ ਦੇ ਬਾਰੇ ਜਾਣਦੇ ਨੇ ਅਤੇ ਆਪਣੇ ਗਿਆਨ ਵਿੱਚ ਵਾਧਾ ਕਰਦੇ ਨੇ ਜਿਸ ਦੇ ਵਿੱਚ ਉਹਨਾਂ ਨੂੰ ਹਰ ਤਰ੍ਹਾਂ ਦਾ ਗਿਆਨ ਆਪਣੇ ਆਸ ਪਾਸ ਵਾਪਰ ਰਹੀਆਂ ਘਟਨਾਵਾਂ ਮਹਿੰਗਾਈ ਰੋਜ਼ ਮਰਰਾ ਦੀਆਂ ਜ਼ਰੂਰਤਾਂ ਦੀਆਂ ਚੀਜ਼ਾਂ ਅਤੇ ਹੋਰ ਕਾਫੀ ਕੁਝ ਮਿਲ ਜਾਂਦਾ ਹੈ ਜਿਸ ਦੇ ਨਾਲ ਉਹਨਾਂ ਨੂੰ ਆਪਣੇ ਜੀਵਨ ਨੂੰ ਸੁਖਾਲਾ ਕਰਨ ਲਈ ਕਈ ਤਰ੍ਹਾਂ ਦੇ ਪ੍ਰੋਡਕਟ ਬਾਰੇ ਜਾਣਕਾਰੀ ਅਤੇ ਆਪਣੇ ਭਵਿੱਖ ਨੂੰ ਉੱਪਰ ਲਿਜਾਣ ਲਈ ਜਾਣਕਾਰੀ ਮਿਲ ਜਾਂਦੀ ਹੈ ਅਖਬਾਰਾਂ ਦੀਆਂ ਖਬਰਾਂ ਦੇ ਵਿੱਚ ਹਰ ਤਰ੍ਹਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਜਿਸ ਨਾਲ ਨੌਜਵਾਨ ਪੀੜ੍ਹੀ ਆਪਣੇ ਗਿਆਨ ਵਿੱਚ ਵਾਧਾ ਕਰ ਸਕਦੀ ਏ